ਜਦੋਂ ਕੋਈ ਆਪਣੇ ਗਲੇ ਦਾ ਜ਼ਰੂਰਤ ਤੋਂ ਜ਼ਿਆਦਾ ਇਸਤੇਮਾਲ ਕਰਦਾ ਹੈ ਜਿਸ ਤਰ੍ਹਾਂ ਜ਼ਿਆਦਾ ਟਾਇਮ ਗਾਉਣਾ ਅਤੇ ਜ਼ੋਰ ਦੀ ਆਵਾਜ਼ ਨਿਕਾਲ ਕੇ ਗਾਉਣਾ ਉਸ ਨਾਲ ਬਿਲਕੁਲ ਥਕਾਵਟ ਹੋ ਜਾਂਦੀ ਹੈ ਆਵਾਜ਼ ਦਾ ਗੁੜ੍ਹਾਪਨ ਚਲਾ ਜਾਂਦਾ ਹੈ ਅਸੀਂ ਆਪਣੀ ਆਵਾਜ਼ ਦੀ ਸੁਰੱਖਿਆ ਕਈ ਤਰ੍ਹਾਂ ਨਾਲ਼ ਕਰ ਸਕਦੇ ਹਾਂ ਜਿਸ ਤਰ੍ਹਾਂ ਕਈ ਤਰ੍ਹਾਂ ਦੇ ਨਾਲ ਗਲੇ ਦੀਆਂ ਕਸਰਤਾਂ ਹਨ ਬਾਕੀ ਰੋਜ਼ਮੱਰਾ ਜ਼ਿੰਦਗੀ ਵਿੱਚ ਖਾਣ ਪੀਣ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਵੇਂ ਕਿ ਚਾਹ ਦਾ ਸੇਵਨ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ ਵਾਰ ਵਾਰ ਪਾਣੀ ਪੀਂਦੇ ਰਹਿਣਾ ਚਾਹੀਦਾ ਹੈ ਖੱਟੀਆਂ ਤਲੀਆਂ ਚੀਜ਼ਾਂ ਦਾ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਬੋਲਣਾ ਉਂ ਥੋੜ੍ਹਾ ਘੱਟ ਹੀ ਚਾਹੀਦਾ ਹੈ